ਹੈਲੋ ਸਤਿ ਸ਼੍ਰੀ ਅਕਾਲ ਵੀਰੇ ਵਧੀਆ ਤੁਸੀਂ ਦੱਸੋ ਕਿਵੇਂ ਚੱਲਦੀ ਆ ਸਟੱਡੀ ਤੁਹਾਡੀ ਆਪਣੇ ਬਹੁਤ ਬਸ ਬਹੁਤ ਵਧੀਆ ਕੁਛ ਨਹੀਂ ਬਸ ਮੈਂ ਤੁਹਾਨੂੰ ਦੱਸਣਾ ਸੀਗਾ ਕਿ ਜਿਵੇਂ ਤੁਹਾਨੂੰ ਪਤਾ ਹੀ ਆ ਮੈਂ ਪਲੱਸ ਟੂ ਤੋਂ ਬਾਅਦ ਆਈਲੈਟਸ ਕੀਤੀ ਸੀਗੀ ਅਤੇ ਮੇਰੇ ਉਹ 'ਚ ਬਹੁਤ ਵਧੀਆ ਬੈਂਡ ਆ ਗਏ ਨੇ ਸਾਢੇ ਸੱਤ ਬੈਂਡ ਆਏ ਨੇ ਹਾਂ ਅਤੇ ਮੈਂ ਹੁਣ ਤੁਹਾਨੂੰ ਇਹ ਪੱਛਣਾ ਸੀ ਤੁਸੀਂ ਮੈਨੂੰ ਬਾਹਰ ਭੇਜ ਦਿਉਗੇ ਹਾਂਜੀ ਹਾਂਜੀ ਹਾਂਜੀ ਹਾਂ ਹਾਂ ਹਾਂ ਕੋਈ ਨਾ ਵੀਰੇ ਤੁਸੀਂ ਦੇਖੋ ਇੱਕ ਵਾਰੀ ਮੈਨੂੰ ਬਾਹਰ ਭੇਜ ਦਿਉ ਫੇਰ ਆਪਣੀਆਂ ਸਾਰੀਆਂ ਪ੍ਰੋਬਲਮਸ ਹੱਲ ਹੋ ਜਾਣਗੀਆਂ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਕੋਈ ਨਾ ਵੀਰੇ ਤੁਸੀਂ ਰਿਸ਼ਤੇਦਾਰਾਂ ਨੂੰ ਪੁੱਛ ਲਓ ਆਪਦੇ ਫਰੈਂਡਸ ਨੂੰ ਪੁੱਛ ਲਓ ਕਿਸੇ ਹੋਰ ਤੋਂ ਪੁੱਛ ਲਓ ਬੈਂਕ ਤੋਂ ਲੋਨ ਲੈ ਲਓ ਕੁਛ ਵੀ ਕਰ ਲਓ ਹਾਂਜੀ ਹਾਂਜੀ ਨਹੀਂ ਨਹੀਂ ਵੀਰੇ ਹਾਂਜੀ ਵੀਰੇ ਪਰ ਤੁਸੀਂ ਟਰੱਸਟ ਰੱਖੋ ਮੈਂ ਐਵੇਂ ਕੁਛ ਨਹੀਂ ਕਰਦੀ ਗੀ ਜਿਵੇਂ ਤੁਸੀਂ ਕਹੋਂਗੇ ਉਵੇਂ ਹੀ ਰਹਾਂਗੀ ਤੁਸੀਂ ਬਸ ਇੱਕ ਵਾਰੀ ਬਾਹਰ ਭੇਜ ਦਿਉ ਫਿਰ ਆਪਣੀਆਂ ਸਾਰੀਆਂ ਪ੍ਰੋਬਲਮਸ ਹੱਲ ਹੋ ਜਾਣਗੀਆਂ ਸਾਰਿਆਂ ਦਾ ਕਰਜ਼ਾ ਲੈ ਜੁਗਾ ਹਾਂ ਵੀਰੇ ਹਾਂ ਇਹ ਤਾਂ ਹੈ ਪਰ ਤੁਸੀਂ ਟੈਂਸ਼ਨ ਨਾ ਲਓ ਆਪਾਂ ਵਧੀਆ ਏਜੰਟ ਕੋਲੋਂ ਗੱਲ ਕਰਾਂਗੇ ਜਿੱਥੋਂ ਮੇਰੀ ਇੱਕ ਫਰੈਂਡ ਵੀ ਗਈ ਵੀ ਆ ਉਸ ਏਜੰਟ ਕੋਲੋਂ ਆਪਾਂ ਵੀਜ਼ਾ ਲਵਾ ਲਵਾਂਗੇ ਉਹਨੇ ਵੀ ਉਸ ਏਜੰਟ ਕੋਲੋਂ ਲਗਵਾਇਆ ਸੀ ਹਾਂਜੀ ਹਾਂਜੀ ਹਾਂਜੀ ਹਾਂਜੀ ਉਹਨੇ ਏਜੰਟ ਵਧੀਆ ਉਹਨੇ ਉੱਥੇ ਉਹਦਾ ਰਹਿਣ ਸਹਿਣ ਵੀ ਵਧੀਆ ਕਰਤਾ ਅਤੇ ਉਹਨੂੰ ਕੰਮ ਵੀ ਦਿਵਾਇਆ ਉਹ ਬਹੁਤ ਵਧੀਆ ਰਹਿ ਰਹੀ ਆ ਅਤੇ ਨਾਲ ਨਾਲ ਉਹ ਆਪਦੀ ਸਟੱਡੀ ਵੀ ਕੰਪਲੀਟ ਕਰ ਰਹੀ ਆ ਸਟਡੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਤਾਂ ਬਾਹਰ ਜਾ ਕੇ ਫਿਰ ਇੱਕ ਵਾਰੀ ਬਾਹਰ ਜਾ ਵੜੀ ਉਹ ਤੋਂ ਬਾਅਦ ਮੈਂ ਤੁਹਾਨੂੰ ਵੀ ਲੈ ਜਾਵਾਂਗੀ ਆਪਣੀ ਪੂਰੀ ਫੈਮਿਲੀ ਨੂੰ ਵੀ ਲੈ ਜਾਵਾਂਗੀ ਹਾਂ ਘਰ ਵੀ ਪੈ ਜੂਗਾ ਹਾਂਜੀ ਹਾਂਜੀ ਹਾਂਜੀ ਠੀਕ ਹੈ ਵੀਰੇ ਪਰ ਤੁਸੀਂ ਧਿਆਨ ਰੱਖਿਓ ਜਿੱਥੋਂ ਕਿਤੋਂ ਵੀ ਹੁੰਦਾ ਪੈਸਿਆਂ ਦਾ ਤੁਸੀਂ ਜ਼ਰੂਰ ਕਰਿਓ ਹਾਂ ਠੀਕ ਹੈ ਵੀਰੇ ਠੀਕ ਆ ਵੀਰੇ ਧਿਆਨ ਜ਼ਰੂਰ ਰੱਖਿਓ ਤੁਸੀਂ ਜ਼ਰੂਰ ਗੱਲ ਕਰਿਓ ਅਤੇ ਬੈਂਕ 'ਚ ਵੀ ਪੁੱਛਿਓ ਅਤੇ ਜੇ ਲੋਨ ਮਿਲ ਸਕੇ ਤਾਂ ਬਹੁਤ ਜ਼ਿਆਦਾ ਵਧੀਆ ਆਪਣੇ ਲਈ ਹਾਂ ਠੀਕ ਹੈ ਵੀਰੇ ਧਿਆਨ ਰੱਖਿਓ ਆਪਦਾ ਠੀਕ ਹੈ